ਪੰਜਾਬੀਆਂ ਦੇ ਜੀਵਨ ਦਾ ਜੋਸ਼ ਅਤੇ ਜਿੰਦਾ ਦਿਲੀ ਉਹਨਾਂ ਦੇ ਲੋਕ ਨਾਚਾਂ ਵਿੱਚ ਝਲਕਦੀ ਹੈ ਇਹ ਹਲਾਰੇ ਅਦਾਵਾਂ ਇਸ਼ਾਰਿਆਂ ਬੋਲੀਆਂ ਸੈਣਤਾਂ ਅਤੇ ਆਜ਼ਾਦੀ ਨਾਲ ਭਰੀ ਹੈ ਇਹ ਨਾਚ ਮਨ ਦੀ ਮੁਕਤੀ ਅਤੇ ਖੁਸ਼ੀ ਦਾ ਨਾਚ ਹੈ ਢੋਲ ਜਾਂ ਹੋਰ ਸਾਜ਼ਾਂ ਦੀ ਤਾਲ 'ਤੇ ਪੰਜਾਬੀਆਂ ਦੇ ਪੱਬ ਆਪ ਮੁਹਾਰੇ ਉੱਠ ਪੈਂਦੀਆਂ ਹਨ ਪੰਜਾਬ ਪੰਜਾਬ ਦਾ ਲੋਕ ਨਾਚ ਇੱਥੇ ਹੀ ਜਮ ਇੱਥੇ ਹੀ ਜਨਮਿਆ ਹੈ ਇਹਦੇ ਭਾਵਾਂ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਇੱਕ ਉੱਚੀ ਉਡਾਰੀ ਭਰਨ ਦੀ ਇਹ ਭਰਨੀ ਵੀ ਲੋਚਦਾ ਹੈ ਪੰਜਾਬ ਦੇ ਲੋਕ ਨਾਚ ਇੱਥੋਂ ਦੇ ਲੋਕਾਂ ਵਿੱਚਾਲੇ ਵਿੱਚਲੀ ਊਰਜਾ ਅਤੇ ਜੋਸ਼ ਦਾ ਪ੍ਰਗਟਾਵਾ ਕਰਦੇ ਹਨ ਇਹ ਲੋਕ ਨਾਚ ਪੰਜਾਬੀਆਂ ਦੀ ਜਿੰਦਾ ਦਿਲੀ ਦਾ ਪ੍ਰਮਾਣ ਹੈ ਪ੍ਰਮਾਣ ਦਿੰਦੇ ਹਨ ਇਹ ਜਿਵੇਂ ਭੰਗੜੇ ਦੇ ਇਹ ਕੁਝ ਸਟੈਪ ਜਿੱਦਾਂ ਮੱਖਣੀ ਮਲਾਈ ਪੰਜਾਬ ਇਹ ਝੂਮਰ ਲੁੱਡੀ ਆਦਿ ਬਹੁਤ ਸਾਰੇ ਇਹ ਸਟੈਪ ਹਨ